ਪੰਜਾਬੀ ਪੰਜਾਬ ਦੀ ਭਾਸ਼ਾ ਮੇਰੇ ਲਈ ਸਿਰਫ ਇੱਕ ਭਾਸ਼ਾ ਹੀ ਨਹੀਂ ਸਗੋਂ ਆਪਣੇ ਵਿਅਕਤੀਤਵ ਨੂੰ ਦੂਜਿਆਂ ਅੱਗੇ ਪ੍ਰਸਤੁਤ ਕਰਨ ਦਾ ਇੱਕ ਜ਼ਰੀਆ ਹੈ ਅੱਜ ਮੇਰੀ ਜੋ ਵੀ ਪਹਿਚਾਣ ਹੈ ਪੰਜਾਬੀ ਕਰਕੇ ਹੈ ਮੈਂ ਆਪਣੇ ਸਾਰੇ ਵਿਚਾਰਾਂ ਨੂੰ ਵਿਅਕਤ ਕਰਦਾ ਹਾਂ ਤਾਂ ਸਿਰਫ ਪੰਜਾਬੀ ਵਿੱਚ ਇਹ ਨਹੀਂ ਕਿ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਮੈਂ ਆਪਣੇ ਵਿਚਾਰਾਂ ਨੂੰ ਵਿਅਕਤ ਨਹੀਂ ਕਰ ਸਕਦਾ ਪਰ ਪੰਜਾਬੀ ਬੋਲ ਕੇ ਪੰਜਾਬੀ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਕੇ ਮੈਨੂੰ ਜੋ ਸਕੂਨ ਜੋ ਚੈਨ ਮਿਲਦਾ ਹੈ ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਮਿਲਦਾ ਪੰਜਾਬੀ ਨੇ ਸਾਡੇ ਸੱਭਿਆਚਾਰ ਉੱਪਰ ਗਹਿਰਾ ਪ੍ਰਭਾਵ ਪਾਇਆ ਹੈ ਪੰਜਾਬੀ ਕਰਕੇ ਮੇਰੀ ਪਹਿਚਾਣ ਬਣੀ ਮੈਂ ਅਣਗਿਣਤ ਆਰਟੀਕਲ ਪੰਜਾਬੀ ਭਾਸ਼ਾ ਵਿੱਚ ਲਿਖ ਚੁੱਕਾ ਹਾਂ ਸਿਰਫ ਲਿਖ ਹੀ ਨਹੀਂ ਚੁੱਕਾ ਉਹਨਾਂ ਵਿੱਚ ਆਪਣੇ ਜੀਵਨ ਦੀਆਂ ਕਈ ਘਟਨਾਵਾਂ ਨੂੰ ਵਿਅਕਤ ਕਰ ਚੁੱਕਾ ਹਾਂ ਪੰਜਾਬੀ ਸੱਚ ਮੁੱਚ ਮੇਰੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਕਿਹਾ ਜਾ ਸਕਦਾ ਹੈ